ਤਰਨਤਾਰਨ ਜਿਲ੍ਹੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਬਹੁਤ ਹੀ ਵਧੀਆ ਵਾ ਇਸ ਵਿੱਚ ਡਾ ਡਾਕਟਰੀ ਸਹਿ ਸਹੂਲਤਾਂ ਬਹੁਤ ਹੀ ਵਧੀਆਂ ਬ ਸਾਰਿਆਂ ਨੂੰ ਮਿਲ ਰਹੀਆਂ ਜਿਵੇਂ ਫ੍ਰੀ ਦਵਾਈਆਂ ਉਹ ਮਹੱਲੇ ਦੇ ਵਿੱਚ ਕਲੀਨਿਕ ਖੋਲ੍ਹੇ ਗਏ ਉਹ ਵੀ ਉਹਦੇ ਵਿੱਚ ਵੀ ਆਪਾਂ ਨੂੰ ਫ੍ਰੀ ਦਵਾਈਆਂ ਅਤੇ ਮਰੀਜ਼ ਦੀ ਬਹੁਤ ਹੀ ਦੇਖਭਾਲ ਕੀਤੀ ਗਈ ਆ ਸੋਹਣੇ ਬੈੱਡ ਵਾ ਬੈੱਡ ਸ਼ੀਟ ਬਹੁਤ ਸੋਹਣੀ ਆ ਮਤਲਬ ਕਿ ਡੇਲੀ ਉਹਦੀ ਕਲੀਅ ਸਾਫ਼ ਕੀਤੀ ਜਾਂਦਾ ਵਾ ਅਤੇ ਪੇਸ਼ਟ ਨੂੰ ਮਤਲਬ ਕਿ ਬਹੁਤ ਹੀ ਧਿਆਨ ਦੇ ਨਾਲ ਡਾਕਟਰ ਜਿਹੜੇ ਆ ਉਹ ਮਤਲਬ ਕਿ ਚੈੱਕਅਪ ਕਰਦੇ ਆ ਵੀ ਉਹਨੂੰ ਕੋਈ ਕਿਸੇ ਟਾਈਮ ਕਿਸੇ ਚੀਜ਼ ਤੋਂ ਦਿੱਕਤ ਤਾਂ ਨਹੀਂ ਆ ਰਹੀ ਸੇਵਾਵਾਂ ਹਰੇ ਹੋਰ ਵੀ ਸੇਵਾਵਾਂ ਉਪਲੱਬਧ ਕੀਤੀਆਂ ਗਈਆਂ ਨ ਅਤੇ ਉਹਨਾਂ ਨੂੰ ਭਾਈਚਾਰੇ ਦੀ ਮਦਦ ਹੋਰ ਵੀ ਜਿਹੜਾ ਭਾਈਚਾਰਾ ਵਾ ਉਹ ਵੀ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਜੋ ਵੀ ਉਹਨੂੰ ਚਾਹੀਦਾ ਉਹਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਸੇਵਾਵਾਂ ਜਿਹੜੀ ਵੀ ਜਿਹੜੀ ਜ਼ਰੂਰਤ ਵਾ ਉਹਨੂੰ ਉਹ ਸਭ ਮਿਲ ਰਹੀਆਂ ਵਾ ਅਤੇ ਤਰਨਤਾਰਨ ਜਿਲ੍ਹੇ ਦੇ ਵਿੱਚ ਹਰੇਕ ਹੀ ਸਹੂਲਤ ਜਿਹੜੀ ਉਹ ਮਿਲ ਰਹੀ ਆ ਡਾਕਟਰੀ ਡਾਕਟਰੀ ਸਹੂਲਤਾਂ ਸੇਵਾਵਾਂ ਸਹੂਲਤਾਂ ਹੋਰ ਵੀ ਭਾਈਚਾਰੇ ਜਿਹੜਾ ਵੀ ਲੋੜਵੰਦ ਆ ਉਹਨੂੰ ਉਹਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਹਦੇ ਵਿੱਚ ਮਤਲਬ ਕਿ ਮਰੀਜ਼ ਦਾ ਵੀ ਡਾਕਟਰੀ ਸਹੂਲਤ ਵਿੱਚ ਡਾਕਟਰ ਜਿਹੜੇ ਆ ਬਹੁਤ ਹੀ ਪਿਆਰ ਨਾਲ ਬੋਲਦੇ ਆ ਨਾਲੇ ਚੈੱਕਅਪ ਬਹੁਤ ਵਧੀਆ ਕਰਦੇ ਹਨ ਦਵਾਈਆਂ ਵੀ ਫ੍ਰੀ ਹੀ ਲਿਖ ਕੇ ਅੰਦਰੋਂ ਦਿੰਦੇ ਹਨ ਲਿਖ ਕੇ ਦਿੰਦੇ ਹਨ ਅਤੇ ਮਰੀਜ਼ ਨੂੰ ਮਤਲਬ ਕਿ ਇੱਧਰ ਉੱਧਰ ਭੜਕਣ ਨਹੀਂ ਦਿੰਦੇ ਮਰੀਜ਼ ਦਾ ਬਹੁਤ ਸੋਹਣਾ ਮਤਲਬ ਕਿ ਬਹੁਤ ਹੀ ਧਿਆਨ ਨਾਲ ਗੱਲਬਾਤ ਸੁਣਦੇ ਹਨ ਤਰਨਤਾਰਨ ਜਿਲ੍ਹੇ ਵਿੱਚ ਬਹੁਤ ਹੀ ਸਿਹਤ ਸੰਭਾਲ ਲਈ ਬਹੁਤ ਹੀ ਉਪਰਾਲਾ ਵਧੀਆ ਕੀਤਾ ਗਿਆ ਹੈ